ਹੈਲੋ ਹਾਂਜੀ ਮੇਰਾ ਨਾਮ ਨੀਰੂ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਪੰਜਾਬ ਦੀ ਔਰ ਮੈਂ ਅੱਜ ਆਪਣੇ ਮਤਲਬ ਕਿ ਇਸ ਡਾਂਸ ਦੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਡਾਂਸ ਮਤਲਬ ਜਿਸ ਤਰ੍ਹਾਂ ਕਿ ਮੈਂ ਗਿੱਧੇ 'ਚ ਬਹੁਤ ਹੀ ਮਤਲਬ ਕਿ ਮੈਨੂੰ ਸ਼ੌਂਕ ਹੈ ਔਰ ਮੈਂ ਬਚਪਨ ਤੋਂ ਹੀ ਮਤਲਬ ਕਿ ਡਾਂਸ 'ਚ ਹਰ ਮਤਲਬ ਕਿ ਡਾਂਸ ਕਰਦੀ ਰਹੀ ਹਾਂ ਔਰ ਮੈਨੂੰ ਮਤਲਬ ਕਿ ਬਹੁਤ ਹੀ ਜਗ੍ਹਾ 'ਤੇ ਮੈ ਮਤਲਬ ਕਿ ਗਈ ਹੋਈ ਆ ਔਰ ਮੈਨੂੰ ਬਹੁਤ ਮਤਲਬ ਕਿ ਇਨਾਮ ਵੀ ਮਿਲੇ ਆ ਮੈਨੂੰ ਬੋ ਮਤਲਬ ਕਿ ਜੋ ਵੀ ਗਿੱਧਾ ਮੈਂ ਕਰਦੀ ਸੀ ਔਰ ਹਰ ਗਿੱਧੇ 'ਚ ਮੈਂ ਸ ਸਾਨੂੰ ਮਤਲਬ ਕਿ ਮੈਂ ਸ਼ਾਮਿਲ ਹੁੰਦੀ ਰਹੀ ਹਾਂ 'ਤੇ ਕਰਦੀ ਰਹੀ ਹਾਂ ਮਤਲਬ ਕਿ ਮੈਨੂੰ ਬਹੁਤ ਹੀ ਵਧੀਆ ਮਤਲਬ ਕਿ ਲੱਗਿਆ ਮਤਲਬ ਗਿੱਧਾ ਮੈਨੂੰ ਮੇਰੀ ਮੰਨਪਸੰਦ ਮਤਲਬ ਕਿ ਡਾਂਸ ਹੈ ਔਰ ਮੈਂ ਮਤਲਬ ਕਿ ਆਪਣੀ ਸਟੇਜ ਪਠਾਨਕੋਟ 'ਚ ਵੀ ਔਰ ਹੋਰ ਕਿਤੇ ਹੋਰ ਅਮ੍ਰਿਤਸਰ ਵਗੈਰਾ ਸ਼ੋਸ਼ਲ ਮੀਡੀਆ ਵਾਲਿਆਂ ਨੇ ਵੀ ਮੈਨੂੰ ਬਹੁਤ ਹੀ ਵਧੀਆ ਮਤਲਬ ਕਿ ਪਸੰਦ ਕੀਤਾ ਜਿਵੇਂ ਕਿ ਤੀਆਂ ਦਾ ਮੇਲਾ ਹੁੰਦਾ ਉੱਥੇ ਵੀ ਮੈਂ ਮਤਲਬ ਕਿ ਕਰਦੀ ਹਾਂ ਹੋਰ ਮਤਲਬ ਕੋਈ ਮਤਲਬ ਜਿਸ ਤਰ੍ਹਾਂ ਮਤਲਬ ਆਪਣੇ ਸਟੇਜ ਮਤਲਬ ਕਿ ਕਿਤੇ ਹੋਰ ਬਾਹਰ ਜਾਣਾ ਪਏ ਮਤਲਬ ਉੱਥੇ ਵੀ ਮੈਂ ਜਾਂਦੀ ਰਹੀ ਹਾਂ ਔਰ ਬਹੁਤ ਹੀ ਵਧੀਆ ਮਤਲਬ ਕੀ ਹੈ ਮੇਰੀ ਉਹ ਹੈ ਮੀਡੀਆ ਨੇ ਬਹੁਤ ਹੀ ਜ਼ਿਆਦਾ ਮੈਨੂੰ ਪਸੰਦ ਕੀਤਾ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਲਾਈਕ ਕੀਤਾ ਔਰ ਮੈਂ ਮਤਲਬ ਕਿ ਤੁਸੀਂ ਸੋਸ਼ਲ ਮੀਡੀਆ ਵਾਲਿਆਂ ਨੇ ਮੈਨੂੰ ਮਤਲਬ ਕਿ ਹੁਣ ਵੀ ਬਹੁਤ ਹੀ ਲਾਈਕ ਕਰਦੇ ਹੈ ਮੈਨੂੰ ਬਹੁਤ ਹੀ ਵਧੀਆ ਮਤਲਬ ਕੀ ਹੈ ਗਿੱਧਾ ਲੱਗਿਆ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੇਰਾ ਹੋਪ ਔਰ ਮੇਰਾ ਮਤਲਬ ਕਿ ਸ਼ੌਕ ਸੀ ਕਿ ਮੈਂ ਗਿੱਧਾ ਗਿੱਧੇ ਵਿੱਚ ਮੈਂ ਮਤਲਬ ਵੀ ਵਧਾ ਔਰ ਮੈਨੂੰ ਬਹੁਤ ਹੀ ਮਤਲਬ ਕਿ ਮੈਂ ਜਿੱਥੇ ਵੀ ਮਤਲਬ ਕੋਈ ਫੰਕਸ਼ਨ ਹੋਣਾ ਕਾਫੀ ਜਗ੍ਹਾ 'ਤੇ ਮੈਂ ਸੈਮੀਨਾਰ ਕੇ 'ਤੇ ਗਈ ਹਾਂ ਔਰ ਮੈਨੂੰ ਮਤਲਬ ਕਿ ਕਾਫੀ ਪ੍ਰਾਈਜ਼ ਵਗੈਰਾ ਮਿਲੇ ਮਤਲਬ ਇਸ ਤਰ੍ਹਾਂ ਕਰਕੇ ਮਤਲਬ ਕਿ ਹੱਦ ਹੁਣ ਵੀ ਮੈਂ ਜਿਹਨੂੰ ਵੀ ਕਹਾਂਗੀ ਮੈਂ ਹੋਰ ਮਤਲਬ ਕਿ ਇਹੀ ਉਹਨਾਂ ਨੂੰ ਬੋਲਣਾ ਚਾਹਾਂਗੀ ਕਿ ਮਤਲਬ ਕਿ ਸਾਡਾ ਇੱਕ ਪੰਜਾਬ ਦੇ ਵਿੱਚ ਮਤਲਬ ਜਿਸ ਇੱਕ ਭੰਗੜਾ ਉਸੇ ਤਰ੍ਹਾਂ ਇੱਕ ਮਤਲਬ ਕਿ ਗਿੱਧਾ ਜਿਹਨੂੰ ਕਿ ਮੈਂ ਫੇਮਸ ਮਤਲਬ ਕਿ ਮੇਨ ਮੰਨਿਆ ਜਾਂਦਾ ਹੈ ਅੱਜ ਦੇ ਮਤਲਬ ਕਿ ਜਿਸ ਤਰ੍ਹਾਂ ਕਿ ਬੱਚੇ ਆ ਉਹਨਾਂ ਨੂੰ ਇਸ ਬਾਰੇ ਇੰਨਾ ਨਹੀਂ ਪਤਾ ਜੋ ਕਿ ਮਤਲਬ ਬੱਚੇ ਅੱਜ ਕੱਲ੍ਹ ਦੇ ਮਤਲਬ ਕਿ ਦੂਸਰੇ ਹਿੰਦੀ ਗਾਣੇ ਇੰਗਲਿਸ਼ ਗਾਣੇ ਲਾ ਕੇ ਮਤਲਬ ਕਿ ਕਰਦੇ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਵੀ ਨਹੀਂ ਮਤਲਬ ਕਿ ਉਹਨਾਂ ਦੇ ਘਰਦਿਆਂ ਨੂੰ ਬੋਲਣਾ ਚਾਹੁੰਦੀ ਹਾਂ ਵੀ ਮਤਲਬ ਕਿ ਬਹੁਤ ਹੀ ਵਧੀਆ ਮਤਲਬ ਕਿ ਆਪਣੇ ਬੱਚੇ ਨੂੰ ਇਸ ਗਿੱਧੇ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਮਤਲਬ ਕਿ ਪਾਉਣਾ ਚਾਹੀਦਾ ਹੈ ਕਿ ਜਿਸ ਕਰਕੇ ਮਤਲਬ ਬੱਚੇ ਬਹੁਤ ਹੀ ਵਧੀਆ ਮਤਲਬ ਕਿ ਲੱਗਦਾ ਹੈ ਇੱਕ ਮਤਲਬ ਕਿ ਅਲੱਗ ਲੱਗਦਾ ਹੈ ਗਿੱਧਾ ਪਾਉਣਾ ਜਿਵੇਂ ਮਤਲਬ ਕਿ ਪੰਦਰਾਂ ਅਗਸਤ ਹੋ ਗਿਆ ਛੱਬੀ ਜਨਵਰੀ ਹੋ ਗਈ ਔਰ ਵੀ ਸਕੂਲਾਂ 'ਚੋਂ ਕਈ ਫੰਕਸ਼ਨ ਮਤਲਬ ਕਿ ਮੈਂ ਮੈਂ ਕੀਤੇ ਆ ਮਤਲਬ ਕਿ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਮੇਰੇ ਇਹਨਾਂ ਮਤਲਬ ਕਿ ਗਿੱਧੇ ਵਿੱਚ ਬਹੁਤ ਹੀ ਮੈਨੂੰ ਮਤਲਬ ਕਿ ਸਾਰਿਆਂ ਨੇ ਲਾਈਕ ਕੀਤਾ ਮਤਲਬ ਅੱਛਾ ਅੱਛੇ ਤਰੀਕੇ ਦੇ ਨਾਲ ਮੈਂ ਮਤਲਬ ਕਿ ਕਰਦੀ ਰਹੀ ਹਾਂ ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਮਤਲਬ ਕਿ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਮਤਲਬ ਕਿ ਗਿੱਧੇ ਦੇ ਵਿੱਚ ਮਤਲਬ ਕਿ ਵੱਧ ਤੋਂ ਵੱਧ ਮਤਲਬ ਕਿ ਉਹਨਾਂ ਨੂੰ ਕਰਵਾਓ ਅਤੇ ਉਹਨਾਂ ਨੂੰ ਆਪਣਾ ਸੱਭਿਆਚਾਰ ਦਾ ਵੀ ਪਤਾ ਲੱਗੇ ਕਿ ਸਾਡੇ ਪੰਜਾਬ ਵਿੱਚ ਮਤਲਬ ਕਿ ਇਹ ਬਹੁਤ ਹੀ ਵਧੀਆ ਮਤਲਬ ਕਿ ਇੱਕ ਨਾਚ ਹੈ ਇਸ ਲਈ ਮੈਂ ਮਤਲਬ ਕਿ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਨੂੰ ਬਹੁਤ ਹੀ ਵਧੀਆ ਮਤਲਬ ਕਿ ਸਭ ਨੇ ਪਸੰਦ ਵੀ ਕੀਤਾ ਔਰ ਲਾਈਕ ਵੀ ਕੀਤਾ ਮਤਲਬ ਕਿ ਸ਼ੇਅ ਮਤਲਬ ਕਿ ਬਹੁਤ ਹੀ ਵਧੀਆ ਉਹਨਾਂ ਨੇ ਮੈਨੂੰ ਮਤਲਬ ਕਿ ਅੱਛੇ ਕਮੈਂਟ ਕੀਤੇ ਕਿ ਤੁਸੀਂ ਬਹੁਤ ਹੀ ਵਧੀਆ ਮਤਲਬ ਕਿ ਗਿੱਧਾ ਮਤਲਬ ਪਾਉਂਦੇ ਹੋ ਥੈਂਕ ਯੂ